ਮੇਰਾ ਪਰਿਵਾਰ ਮੇਰੇ ਪਰਿਵਾਰ ਵਿੱਚ ਮੈਂ ਮੇਰੇ ਪਿਤਾ ਜੀ ਮੇਰੀ ਮਾਤਾ ਜੀ ਅਤੇ ਮੇਰਾ ਛੋਟਾ ਭਰਾ ਅਤੇ ਇੱਕ ਮੇਰੀ ਛੋਟੀ ਭੈਣ ਹੈ ਅਸੀਂ ਪੰਜ ਜਣੇ ਰਹਿੰਦੇ ਹਾਂ ਮੈਂ ਆਪਣੇ ਮਾਤਾ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹਾਂ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮੈਨੂੰ ਪਾਲ਼ਿਆ ਪੋਸ਼ਿਆ ਪੜ੍ਹਾਇਆ ਲਿਖਾਇਆ ਅੱਜ ਤੱਕ ਸਾਡਾ ਖਰਚਾ ਚੁੱਕਿਆ ਅਤੇ ਮੈਂ ਆਪਣੇ ਛੋਟੇ ਭਰਾ ਭੈਣ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਜਿਨ੍ਹਾਂ ਨਾਲ਼ ਮੈਂ ਆਪਣੀਆ ਸਾਰੀਆਂ ਸਾ ਗੱਲਾਂ ਸਾਂਝੀਆਂ ਕਰਦਾ ਹਾਂ ਜੋ ਕਿ ਹੋਰ ਕਿਸੇ ਨਾਲ਼ ਨਹੀਂ ਕਰ ਸਕਦਾ ਜੋ ਮੇਰੇ ਮੇਰਾ ਪਰਿਵਾਰ ਹੈ ਜੋ ਬਹੁਤ ਹੀ ਸੋਹਣਾ ਅਤੇ ਸੁਖੀ ਪਰਿਵਾਰ ਹੈ ਮੇਰਾ ਪਰਿਵਾਰ ਮੇਰਾ ਛੋਟਾ ਭਰਾ ਮੇਰੇ ਨਾਲ ਸਾਰੀਆਂ ਆਪਣੀਆਂ ਗੱਲਾਂ ਸਾਂਝੀਆਂ ਕਰਦਾ ਹੈ ਮੇਰੇ ਨਾਲ਼ ਹੱਸਦਾ ਖੇਡਦਾ ਹੈ ਅਤੇ ਮੇਰੀ ਭੈਣ ਵੀ ਘਰ ਦਾ ਸਾਰਾ ਕੰਮ ਕਰਦੀ ਹੈ ਅਤੇ ਮੈਂ ਵੀ ਕਈ ਵਾਰੀ ਉਸਦਾ ਹੱਥ ਕੰਮ ਵਿੱਚ ਵਟਾ ਦਿੰਦਾ ਹਾਂ ਅਤੇ ਸਾਰੇ ਅਸੀਂ ਸੁਖੀ ਸੁਖੀ ਰਹਿੰਦੇ ਹਾਂ ਅਤੇ ਮੈਂ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਆਪਣੇ ਪਰਿਵਾਰ ਵਿੱਚ ਵੀ ਸਾਰਿਆ ਸੁਖੀ ਵਸੀ ਸੁਖੀ ਵੱਸਦੇ ਦੇਖਣਾ ਚਾਹੁੰਦਾ ਹਾਂ ਮੇਰੀ ਪਰਮਾਤਮਾ ਅੱਗੇ ਇਹੀ ਖਾਹਿਸ਼ ਹੈ ਕਿ ਮੇਰੇ ਘਰਦੇ ਵੱਸਦੇ ਰਹਿਣ ਸਾਰੇ ਜਿਹਨਾਂ ਨੇ ਸਾਨੂੰ ਪਾਲ਼ ਪੋਸ਼ ਕੇ ਬੜਾ ਕੀਤਾ ਅਤੇ ਮੇਰੇ ਘਰਦਿਆਂ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਕੋਈ ਗਲਤ ਕੰਮ ਕੀਤਾ ਹੈ ਅਤੇ ਮੈਨੂੰ ਕਦੇ ਕੁੱਟਿਆ ਹੋਵੇ ਕਿਉਂਕਿ ਗਲਤ ਕੰਮ ਕੋਈ ਕੀਤਾ ਨਹੀਂ ਅਤੇ ਮੇਰਾ ਪਰਿਵਾਰ ਬਹੁਤ ਹੀ ਸੋਹਣਾ ਅਤੇ ਛੋਟਾ ਜਿਹਾ ਪਰਿਵਾਰ ਹੈ ਅਤੇ ਅਸੀਂ ਬੜੇ ਓਏ ਸੁਖੀ ਸ ਅਤੇ ਵਧੀਆ ਤਰੀਕੇ ਢੰਗ ਨਾਲ ਰਹਿੰਦੇ ਹਾਂ ਅਤੇ ਮੇਰਾ ਮੇਰੇ ਪਿਤਾ ਜੀ ਹੈ ਜੋ ਉਹ ਡਰਾਈਵਰੀ ਦਾ ਕੰਮ ਕਰਦੇ ਹਨ ਅਤੇ ਮੇਰੀ ਮਾਤਾ ਜੀ ਘਰ ਦਾ ਕੰਮ ਕਰਦੇ ਹਨ ਅਤੇ ਮੇਰੇ ਪਿਤਾ ਜੀ ਨੇ ਮੈਨੂੰ ਹੁਣ ਹੀ ਹਾਲੀ ਨਵਾਂ ਹੀ ਫ਼ੋਨ ਲੈ ਕੇ ਦਿੱਤਾ ਹੈ ਜੋ ਕਿ ਜਿਸਦੀ ਮੈਨੂੰ ਬਹੁਤ ਹੀ ਜ਼ਰੂਰਤ ਸੀ ਅਤੇ ਮੈਂ ਆਪਣੇ ਪਿਤਾ ਜੀ ਦਾ ਸ਼ੁਕਰਗੁਜ਼ਾਰ ਹਾਂ ਜੋ ਕਿ ਸਾਡੇ ਪੂਰੇ ਘਰ ਦਾ ਖਰਚਾ ਚੱਕਦੇ ਹਨ ਅਤੇ ਆਪਣੀ ਮਾਂ ਦਾ ਵੀ ਦਿਲੋਂ ਸ਼ੁਕਰ ਅ ਸ਼ੁਕਰੀਆ ਕਰਦਾ ਹਾਂ ਜੋ ਕਿ ਸਾਡੇ ਘਰ ਨੂੰ ਸਾਂਭ ਕੇ ਰੱਖਦੀ ਹੈ ਜਿਸ ਨੇ ਸਾਡੇ ਘਰ ਨੂੰ ਇੱਕ ਜੁੱਟ ਬਣਾ ਕੇ ਰੱਖਿਆ ਹੋਇਆ ਹੈ ਅਤੇ ਮੈਂ ਆਪਣੇ ਪਰਿਵਾਰ ਨੂੰ ਬਹੁਤ ਹੀ ਪਿਆਰ ਕਰਦਾ ਹਾਂ ਬਹੁਤ ਹੀ ਜ਼ਿਆਦਾ ਅਤੇ ਗੱਲ ਕਰਾਂ ਜੇ ਮੈਂ ਆਪਣੇ ਦੋਸਤਾਂ ਦੀ ਤਾਂ ਮੇਰੇ ਦੋਸਤ ਵੀ ਬਹੁਤ ਹੀ ਪਿਆਰੇ ਅਤੇ ਵਧੀਆ ਮਿੱਤਰ ਨੇ ਅਤੇ ਬਹੁਤ ਜ਼ਿਆਦਾ ਤਾਂ ਮੇਰੇ ਕੋਲ਼ ਦੋਸਤ ਹੈ ਨਹੀਂ ਬਸ ਦੋ ਚਾਰ ਗਿਣਵੇਂ ਚੁਣਵੇਂ ਯਾਰ ਨੇ ਜਿਹੜੇ ਕਿ ਮੇਰੇ ਨਾਲ ਮਾੜੇ ਸਮੇਂ ਵਿੱਚ ਵੀ ਖੜ੍ਹੇ ਨੇ ਅਤੇ ਕੁਝ ਕੁ ਯਾਰ ਇਹ ਜਿਹੇ ਅਜਿਹੇ ਵੀ ਸਨ ਜਿਹੜੇ ਕਿ ਮਾੜਾ ਮਾੜਾ ਟਾਈਮ ਦੇਖ ਕੇ ਸਾਨੂੰ ਛੱਡ ਗਏ ਸੀ ਅਤੇ ਅੱਜ ਉਹ ਦੋ ਚਾਰ ਯਾਰ ਗਿਣਵੇਂ ਚੁਣਵੇਂ ਜਿਹੜੇ ਮੇਰੇ ਨਾਲ਼ ਅੱਜ ਵੀ ਖੜ੍ਹੇ ਸੀ ਅਤੇ ਕੱਲ ਵੀ ਖੜ੍ਹਨਗੇ ਅਤੇ ਜੋ ਮੇਰੇ ਯਾਰ ਹਨ ਬੜੇ ਹੀ ਪੱਕੇ ਦਿਲ ਦੇ ਪਿਆਰੇ ਅਤੇ ਨਰਮ ਸੁਭਾਅ ਵਾਲੇ ਹਨ ਕਦੇ ਵੀ ਲੜਦੇ ਨਹੀਂ ਦੇਖੇ ਅਤੇ ਮੈਂ ਵੀ ਆਪ ਯਾਰਾਂ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਇਹ ਜਿਗਰੀ ਹਨ ਸਿਰੇ ਦੇ ਇਹ ਮੇਰੇ ਜੋ ਯਾਰ ਹਨ ਹਰਿਮ ਹਮੇਸ਼ਾਂ ਮੇਰੀ ਔਕੜ ਵਿੱਚ ਸਾਥ ਦੇਣ ਵਾਲੇ ਹਨ ਮਾੜੇ ਟਾਈਮ ਵਿੱਚ ਕਦੇ ਸਾਥ ਨਹੀਂ ਛੱਡਦੇ ਅਤੇ ਮੈਂ ਆਪਣੇ ਯਾਰਾਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਭਾਵੇਂ ਇਹ ਸਾਡਾ ਫਰੈਂਡ ਸਰਕਲ ਜਮਾ ਹੀ ਛੋਟਾ ਹੈ ਪਰ ਜਿੰਨਾ ਛੋਟਾ ਹੈ ਓਨਾ ਵਧੀਆ ਹੈ ਇਸ ਕਰਕੇ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਬਹੁਤ ਹੀ ਪਿਆਰ ਕਰਦਾ ਹਾਂ